ਮੇਰੇ ਆਰਟ ਕਲਾਸ ਦੇ ਅਧਿਆਪਕਾਂ ਨੇ ਮੇਰਾ ਬਹੁਤ ਸਹਿਯੋਗ ਦਿੱਤਾ ਹੈ ਅਤੇ ਉਨ੍ਹਾਂ ਨੇ ਮੈਨੂੰ ਬਹੁਤ ਚੰਗੀ ਪੇਂਟਿੰਗ ਬਣਾਉਣ ਵਾਸਤੇ ਬਹੁਤ ਆਸਾਨ ਟ੍ਰਿਪਸ ਟ੍ਰਿਕਸ ਅਤੇ ਟਿਪਸ ਦਿੱਤੇ ਹਨ ਜਿਨ੍ਹਾਂ ਨਾਲ਼ ਮੈਨੂੰ ਪੇਂਟਿੰਗ ਕਰਨ ਵਿੱਚ ਬਹੁਤ ਆਸਾਨੀ ਹੁੰਦੀ ਹੈ ਮੈਨੂੰ ਪੇਂਟਿੰਗਸ ਬਣਾਉਣ ਦਾ ਬਹੁਤ ਸ਼ੌਕ ਹੈ ਮੈਂ ਘਰ ਵਿੱਚ ਬਹੁਤ ਸਾਰੀਆਂ ਪੇਂਟਿੰਗਸ ਬਣਾਉਂਦਾ ਰਹਿੰਦਾ ਹਾਂ ਮੈਨੂੰ ਪੇਂਟਿੰਗਸ ਬਣਾਉਣੀਆਂ ਬਹੁਤ ਵਧੀਆ ਲੱਗਦੀਆਂ ਹਨ ਮੈਂ ਆਪਣੇ ਵਿਹਲੇ ਸਮੇਂ 'ਚ ਪੇਂਟਿੰਗਸ ਬਣਾਉਂਦਾ ਰਹਿੰਦਾ ਹਾਂ